ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਕਿਸ ਤਰ੍ਹਾਂ ਹੈਲਪ ਕਰ ਸਕਦਾ ਜੀ ਮੈਂ ਹਾਂਜੀ ਪੰਜਾਬ ਵਿੱਚ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਰਾਜਧਾਨੀ ਆ ਜਿੱਥੇ ਸ਼ੋਪਿੰਗ ਵਾਸਤੇ ਕਾਫੀ ਵਧੀਆ ਮਾਰਕੀਟ ਹੈ ਉੱਥੇ ਦੁਨੀਆ ਦੇ ਜਿੰਨੇ ਵੀ ਬ੍ਰਾਂਡ ਨੇ ਉਹਨਾਂ ਦੀਆਂ ਸਾਰੀਆਂ ਫੈਨਚਾਈਜ਼ਿਸ ਉੱਥੇ ਮਿਲ ਜਾਂਦੀਆਂ ਨੇ ਅਤੇ ਉੱਥੇ ਤੁਸੀਂ ਆਪਣਾ ਵਧੀਆ ਤਸੱਲੀ ਬਖਸ਼ ਸ਼ੋਪਿੰਗ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਸੀਂ ਹੋਜਰੀ ਦਾ ਸਮਾਨ ਜਾਂ ਖੇਡਾਂ ਦਾ ਸਮਾਨ ਲੈਣਾ ਉਹਦੇ ਵਾਸਤੇ ਜਲੰਧਰ ਸ਼ਹਿਰ ਹੈ ਬਹੁਤ ਵਧੀਆ ਉੱਥੇ ਤੁਹਾਨੂੰ ਸਭ ਹੀ ਵਧੀਆ ਚੀਜ਼ਾਂ ਮਿਲ ਜਾਣਗੀਆਂ ਸਾਈਕਲ ਵਗੈਰਾ ਵੀ ਉੱਥੇ ਕਾਫੀ ਮਿਲ ਜਾਂਦੇ ਨੇ ਇਸ ਤੋਂ ਇਲਾਵਾ ਅਗਰ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਲੈਣੀਆਂ ਨੇ ਤਾਂ ਅੰਮ੍ਰਿਤਸਰ ਹੈ ਅੰਮ੍ਰਿਤਸਰ ਵਿੱਚ ਬੜੀਆਂ ਪਾਪੜ ਆਦਿ ਕਾਫੀ ਮਸ਼ਹੂਰ ਹਨ ਇਸ ਤੋਂ ਇਲਾਵਾ ਅਗਰ ਸੂਟ ਵਗੈਰਾ ਵਾਸਤੇ ਸੋਚ ਰਹੇ ਹੋ ਤਾਂ ਬਠਿੰਡਾ ਸ਼ਹਿਰ ਹੈ ਉੱਥੇ ਕਾਫੀ ਵਧੀਆ ਕੱਪੜੇ ਦੀਆਂ ਵਰਾਇਟੀ ਮਿਲਦੀਆਂ ਨੇ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਵੀ ਤੁਸੀਂ ਕੱਪੜੇ ਜੁੱਤੀਆਂ ਆਦਿ ਦੀ ਸ਼ੋਪਿੰਗ ਕਰ ਸਕਦੇ ਹੋ ਇਸ ਦੇ ਨਾਲ ਹੀ ਅਗਰ ਤੁਸੀਂ ਧਾਰਮਿਕ ਸਥਾਨਾਂ ਬਾਰੇ ਪੁੱਛਣਾ ਤਾਂ ਆਨੰਦਪੁਰ ਸਾਹਿਬ ਹੈ ਤਾਂ ਉੱਥੇ ਤੁਸੀਂ ਘੁੰਮ ਸਕਦੇ ਹੋ ਅੰਮ੍ਰਿਤਸਰ ਜਿਵੇਂ ਕਿ ਜਹਾਨ 'ਚ ਸਭ ਤੋਂ ਮਸ਼ਹੂਰ ਸਿੱਖਾਂ ਦਾ ਮਸ਼ਹੂਰ ਤੀਰਥ ਸਥਾਨ ਹੈ ਉੱਥੇ ਵੀ ਤੁਸੀਂ ਜਾ ਸਕਦੇ ਹੋ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਹੈ ਜਿੱਥੇ ਮਸ਼ਹੂਰ ਕਾਲੀ ਦੇਵੀ ਦਾ ਮੰਦਿਰ ਹੈ ਮੋਤੀ ਗੁਰਦੁਆਰਾ ਮੋਤੀ ਬਾਗ ਹੈ ਅਤੇ ਸ਼ੀਸ਼ ਮਹਿਲ ਹੈ ਉੱਥੇ ਵੀ ਤੁਸੀਂ ਇਤਿਹਾਸਿਕ ਮਾਨਤਾ ਰੱਖਦੇ ਨੇ ਉੱਥੇ ਵੀ ਤੁਸੀਂ ਘੁੰਮ ਸਕਦੇ ਹੋ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਹੈ ਅਤੇ ਚੱਪੜ ਚਿੜੀ ਹੈ ਚੰਡੀਗੜ੍ਹ ਸ਼ਹਿਰ ਕਾਫੀ ਮਸ਼ਹੂਰ ਘੁੰਮਣ ਵਾਸਤੇ ਕਾਫੀ ਵਧੀਆ ਇਸ ਤੋਂ ਇਲਾਵਾ ਤੁਸੀਂ ਮੁਕਤਸਰ ਵਗੈਰਾ ਵੀ ਦੇਖ ਸਕਦੇ ਹੋ ਉਹ ਵੀ ਇਤਿਹਾਸ ਸ਼ਹਿਰ ਹੈ ਹੋਰ ਕੋਈ ਜਾਣਕਾਰੀ ਜੀ ਠੀਕ ਹੈ ਸ਼ੁਕਰੀਆ ਜੀ